ਹਾਂਜੀ ਮੈਂ ਜੀ ਯੋਗਾ ਕਰਦੀ ਹਾਂ ਯੋਗਾ ਕਰਕੇ ਮੈਨੂੰ ਨੀਂਦ ਅੱਛੀ ਆ ਜਾਂਦੀ ਹੈ ਉੱਦੂ ਬਾਅਦ ਜੇ ਮੈਂ ਨਾ ਯੋਗਾ ਕਰਾਂ ਫੇਰ ਮੈਨੂੰ ਨੀਂਦ ਨਹੀਂ ਆਉਂਦੀ ਫੇਰ ਮੈਂ ਦੋ ਦੋ ਚਾਰ ਚਾਰ ਘੰਟੇ ਜਾਗਦੀ ਰਹਿੰਦੀ ਹਾਂ ਉੱਦੂ ਬਾਅਦ ਦੂਸਰੇ ਦਿਨ ਫੇਰ ਮੈਂ ਫੇਰ ਯੋਗਾ ਕਰਦੀ ਹਾਂ ਓਦਣ ਦੁ ਮੈਨੂੰ ਨੀਂਦ ਬਹੁਤ ਵਧੀਆ ਆਉਂਦੀ ਹੈ ਜੀ ਫੇਰ ਸੌ ਜਾਂਦੀ ਹਾਂ ਸੌ ਕੇ ਫੇਰ ਮੈਂ ਫੇਰ ਫੇਰ ਯੋਗਾ ਕਰ ਲੈਂਦੀ ਹਾਂ ਤੜਕੇ ਉੱਠ ਕੇ ਉੱਠ ਕੇ ਫੇਰ ਫੇਰ ਆਥਣੇ ਵੀ ਕਰਦੀ ਹਾਂ ਤੜਕੇ ਵੀ ਕਰਦੀ ਹਾਂ ਜੀ ਮੈਂ ਵਧੀਆ ਸ਼ਾਂਤੀ ਨਾਲ ਨੀਂਦ ਮੈਨੂੰ ਆ ਜਾਂਦੀ ਹੈ ਜੀ ਯੋਗਾ ਕਰੇ ਤੋਂ ਅਤੇ ਨਹੀਂ ਤਾਂ ਫੇਰ ਮੈਨੂੰ ਨੀਂਦ ਘੱਟ ਆਉਂਦੀ ਹੈ ਯੋਗਾ ਕਰਦੀ ਹਾਂ ਮੈਨੂੰ ਬਹੁਤ ਕਹਿ ਦਿੰਦੇ ਹੈ ਤੂੰ ਯੋਗਾ ਕਰਦੀ ਹੈ ਮੈਂ ਕਹਿ ਦਿੰਦੀ ਹਾਂ ਹਾਂ ਮੈਂ ਯੋਗਾ ਕਰਦੀ ਹਾਂ ਤਾਂ ਕਰਕੇ ਮੈਨੂੰ ਨੀਂਦ ਵਧੀਆ ਆਉਂਦੀ ਹੈ ਜੀ ਹੁਣ ਮੈਂ ਯੋਗੇ ਨਾਲ ਬਹੁਤ ਠੀਕ ਠਾਕ ਹਾਂ ਜੀ ਸਾਰਾ ਕੁਛ ਮੈਨੂੰ ਨੀਂਦ ਨੂੰਦ ਹੋਰ ਹੱਡੀਆਂ ਹੁੱਡੀਆਂ ਮੇਰੀਆਂ ਸਾਰੀਆਂ ਠੀਕ ਹਨ ਹਾਂਜੀ ਗੋਡੇ ਵੀ ਠੀਕ ਹੈ ਜੇ ਮੈਂ ਯੋਗਾ ਕਰ ਲੈਂਦੀ ਹਾਂ ਅੱਧਾ ਕੁ ਘੰਟਾ ਬੈਠ ਜਾਂਦੀ ਹਾਂ ਘੰਟਾ ਸਾਰਾ ਬੈਠ ਲੱਤਾਂ ਬਾਹਾਂ ਜਿਹੀਆਂ ਮਾਰੀ ਜਾਂਦੀ ਹਾਂ ਠੀਕ ਹੋ ਜਾਂਦੀ ਹਾਂ